ਚਿੱਤਰਕਾਰੀ ਵਿੱਚ ਮੈਂ ਇੱਕ ਵਾਰ ਸੁਖਨਾ ਲੇਕ ਦਾ ਜੋ ਚਿੱਤਰ ਬਣਾਇਆ ਸੀਗਾ ਇਸ ਵਿੱਚ ਮੇਰੇ ਵੱਲੋਂ ਕਾਫ਼ੀ ਸਾਰੀ ਡਿਟੇ ਡਿਟੇਲਿੰਗ ਜਿਹੜੀ ਹੈਗੀ ਉਹ ਐਡ ਕੀਤੀ ਗਈ ਸੀ ਜਿਹਦੇ ਵਿੱਚ ਬੋਟਸ ਵਗੈਰਾ ਜਾਂ ਪਿਛਲਾ ਜੋ ਦ੍ਰਿਸ਼ ਪਹਾੜੀ ਦ੍ਰਿਸ਼ ਹੈਗਾ ਉਹ ਵੀ ਦਰਸਾਇਆ ਗਿਆ ਅਤੇ ਝੀਲ ਦੇ ਕਿਨਾਰੇ ਜਾਂ ਇੱਥੇ ਘੁੰਮਦੇ ਲੋਕ ਲੋਕਾਂ ਦੇ ਚਿੱਤਰ ਵੀ ਬਣਾਏ ਗਏ ਅਤੇ ਇਹਦੇ ਵਿੱਚ ਜਿਹੜੀ ਮੌਨ ਮੇਨ ਤੌਰ 'ਤੇ ਜੋ ਇਸਕਾ ਜੋ ਗੇਟ ਹੈ ਮੇਰੇ ਵੱਲੋਂ ਉਹ ਵੀ ਬਣਾਇਆ ਗਿਆ ਸੀ ਮੈਂ ਇਸ ਚਿੱਤਰਕਾਰੀ ਨੂੰ ਬੜੇ ਆਪਣੇ ਜੀਅ ਜਾਨ ਨਾਲ਼ ਬਣਾ ਕੇ ਜਦੋਂ ਆਪਣੇ ਮਾਪੇ ਮਾਪਿਆਂ ਅਤੇ ਦੋਸਤਾਂ ਯਾਰਾਂ ਦੋਸਤਾਂ ਨੂੰ ਦਿਖਾਇਆ ਗਿਆ ਅਤੇ ਉਹ ਮੇਰੀ ਚਿੱਤਰਕਾਰੀ ਦੇਖ ਕੇ ਕਾਫ਼ੀ ਹੈਰਾਨ ਹੋਏ ਉਹਨਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਅਤੇ ਉਹਨਾਂ ਵੱਲੋਂ ਮੇਰੀ ਚਿੱਤਰਕਾਰੀ ਬਾਰੇ ਬੜੇ ਵਧੀਆ ਜੋ ਕਮੈਂਟ ਸੀਗੇ ਦਿੱਤੇ ਗਏ ਉਹਨਾਂ ਨੂੰ ਚਿੱਤਰਕਾਰੀ ਵਿੱਚ ਮੇਰੀ ਚਿੱਤਰਕਾਰੀ ਵਿੱਚ ਜੋ ਬਰੀਕੀ ਨਾਲ਼ ਕਿਸ਼ਤੀਆਂ ਜਾਂ ਫਿਰ ਪਹਾੜੀ ਏਰੀਏ ਨੂੰ ਦਰਸਾਇਆ ਗਿਆ ਉਹਨਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ ਅਤੇ ਮੈਂ ਬੜਾ ਖੁਸ਼ ਹਾਂ